ਮੈਂ ਵਰਿੰਦਰ ਕੁਮਾਰ ਜਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਹਾਂ ਮੈਨੂੰ ਵੀ ਡਾਂਸ ਰੀਲਾਂ ਅਤੇ ਸ਼ਾਰਟਸ ਦੇਖਣ ਦਾ ਬਹੁਤ ਸ਼ੌਕ ਹੈ ਅੱਜ ਕੱਲ੍ਹ ਹਰ ਇਨਸਾਨ ਥੋੜ੍ਹਾ ਸਮਾਂ ਸ਼ੋਰਟਸ ਅਤੇ ਰੀਲਾਂ ਨੂੰ ਦੇਖਦਾ ਹੈ ਅਤੇ ਮੈਨੂੰ ਸ਼ੋਰਟਸ ਅਤੇ ਰੀਲਾਂ 'ਤੇ ਡਾਂਸ ਦੇਖਣ ਦਾ ਬਹੁਤ ਸ਼ੌਕ ਹੈ ਅੱਜ ਕੱਲ੍ਹ ਬਹੁਤ ਸਾਰੇ ਡਾਂਸਰ ਸੋਸ਼ਲ ਮੀਡੀਆ 'ਤੇ ਆਪਣੇ ਆਪਣੇ ਸ਼ੋਟਸ ਅਤੇ ਡਾਂਸ ਦੀਆਂ ਰੀਲਾਂ ਪਾਉਂਦੇ ਹਨ ਪਰ ਮੇਰਾ ਮਨ ਪਸੰਦ ਪਸੰਦੀਦਾ ਡਾਂਸਰ ਪੰਕਜ ਡਾਂਸਰ ਹੈ ਜੋ ਪਠਾਨਕੋਟ ਦਾ ਹੈ ਉਸ ਉਹ ਰੋਜ਼ ਦੇ ਦੋ ਤਿੰਨ ਰੀਲਾਂ ਦੇ ਉੱਥੇ ਫੋਲੋ ਸੋਸ਼ਲ ਮੀਡੀਆ 'ਤੇ ਅਪਲੋਡ ਕਰਦਾ ਹੈ ਅਤੇ ਲੋਕ ਉਸਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਉਸਦੇ ਬਹੁਤ ਸਾਰੇ ਵਿਊਅਰ ਹਨ ਅਤੇ ਮੈਂ ਵੀ ਉਸ ਦੇ ਡਾਂਸ ਅਤੇ ਰੀਲਸ ਜਿਹੜਾ ਦੇਖਦਾ ਹਾਂ ਅਤੇ ਉਹਨਾਂ 'ਤੇ ਕਮੈਂਟ ਪਾਸ ਕਰਦਾ ਹਾਂ ਅਤੇ ਉਹ ਜਦੋਂ ਕਮੈਂਟ ਪੜ੍ਹਦਾ ਹੈ ਤਾਂ ਮੈਨੂੰ ਰਿਪਲਾਈ ਵੀ ਕਰਦਾ ਹੈ ਅਤੇ ਆਪਣੇ ਨਿੱਜੀ ਲਾਈਫ ਬਾਰੇ ਵੀ ਸ਼ੇਅਰ ਕਰਦਾ ਹੈ ਅਤੇ ਉਸ ਨੂੰ ਬਹੁਤ ਲੋਕ ਜਿਹੜੇ ਪਸੰਦ ਕਰਦੇ ਹਨ ਅਤੇ ਉਹ ਇੱਕ ਪਠਾਨਕੋਟ ਦਾ ਬਹੁਤ ਹੀ ਫੇਮਸ ਡਾਂਸਰ ਹੈ ਅਤੇ ਆਪਣੇ ਲਾਈਫ ਵਿੱਚ ਵੱਧ ਤੋਂ ਵੱਧ ਤਰੱਕੀ ਕਰਕੇ ਉਹ ਅੱਗੇ ਜਾਵੇਗਾ ਅਤੇ ਆਪਣੇ ਜ਼ਿੰਦਗੀ ਦਾ ਮੁਕਾਮ ਹਾਸਿਲ ਕਰੇਗਾ ਡਾਂਸ ਇੱਕ ਅਜਿਹਾ ਮੁਕਾਮ ਹੈ ਜਿਸ ਤੋਂ ਪ੍ਰੇਰਿਤ ਹੋ ਕੇ ਆਦਮੀ ਮੰਨੋ ਜ਼ਮੀਨ ਤੋਂ ਆਸਮਾਨ ਤੱਕ ਪਹੁੰਚ ਜਾਂਦਾ ਹੈ ਧੰਨਵਾਦ ਜੀ